ਮੇਰ ਮੇਰਾ ਬਿਜਲੀ ਬਿੱਲ ਭੁਗਤਾਨ ਨਹੀਂ ਹੋਇਆ ਤਾਂ ਮੈਂ ਬਿਜਲੀ ਬੋਰਡ ਦੀ ਕਾਲ ਸੇਵਾ ਉੱਤੇ ਕਾਲ ਕਰਾਂਗੀ ਜਦੋਂ ਮੈਂ ਬਿਜਲੀ ਬੋਰਡ ਦੀ ਗਾਹਕ ਸੇਵਾ ਹੋਟਲਾਇਨ 'ਤੇ ਕਾਲ ਕੀਤੀ ਅਤੇ ਉਹਨਾਂ ਨੇ ਕੌਲ ਚੱਕੀ ਤਾਂ ਉਹਨਾਂ ਮੇਰੀ ਸਮੱਸਿਆ ਬਾਰੇ ਪੁੱਛਿਆ ਅਤੇ ਮੈਂ ਹਾਲ ਹੀ ਆਪਣੇ ਬਿੱਲ ਭੁਗਤਾਨ ਦੀ ਸਥਿਤੀ ਬਾਰੇ ਦੱਸਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਹੁਣ ਹੀ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਹੈ ਮੈਂ ਉਹ ਵੀ ਮੈਂ ਕੈਸ਼ ਰਾਹੀਂ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਸੀ ਅਤੇ ਮੇਰਾ ਬਿਜਲੀ ਬਿੱਲ ਦਾ ਭੁਗਤਾਨ ਅਸਫਲ ਹੋ ਗਿਆ ਅਤੇ ਪਲੀਸ ਮੈਨੂੰ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੇਰਾ ਬਿਜਲੀ ਦਾ ਬਿੱਲ ਭੁਗਤਾਨ ਅਸਫਲ ਕਿਉਂ ਹੋਇਆ ਮੈਂ ਖੁਦ ਜਾ ਕੇ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਸੀ ਅਤੇ ਉਹ ਅਸਫਲ ਕਿਉਂ ਰਿਹਾ ਅਤੇ ਅੱਗੋਂ ਜਵਾਬ ਮਿਲਦਾ ਹੈ ਕਿ ਉਹ ਇਸ ਸਾਰੀ ਸਮੱਸਿਆ ਦਾ ਹੱਲ ਕਰਨਗੇ ਅਤੇ ਜਾਣਨ ਦੀ ਕੋਸ਼ਿਸ਼ ਕਰਨਗੇ